ਸਾਡੇ ਖੇਤਰ ਵਿੱਚ ਕੁਝ ਕਬਾਇਲੀ ਕਲਾਵਾਂ ਇਸ ਪ੍ਰਕਾਰ ਹਨ ਜਿਵੇਂ ਕਿ ਸਾਡੇ ਪੰਜਾਬ ਵਿੱਚ ਤਲਵਾਰ ਗਾਤਰਾ ਵਗੈਰਾ ਵੀ ਬਹੁਤ ਬਣਾਇਆ ਜਾਂਦਾ ਹੈ ਕਿਉਂਕਿ ਇੱਥੇ ਗਾਤਰਾ ਪਾਉਣਾ ਪੰਜਾਬੀਆਂ ਦੀ ਸ਼ਾਨ ਹੈ ਅਤੇ ਅੰਮ੍ਰਿਤ ਛਕਣਾ ਸਾਡੇ ਖੇਤਰ ਵਿੱਚ ਸਾਡੇ ਪੰਜਾਬ ਵਿੱਚ ਪੰਜਾਬੀ ਜੁੱਤੀ ਵੀ ਬਹੁਤ ਵਧੀਆ ਬਣਾਈ ਜਾਂਦੀ ਹੈ ਬਾਕੀ ਦੇਸ਼ ਵਿਦੇਸ਼ਾਂ 'ਚ ਵੀ ਪੰਜਾਬੀ ਜੁੱਤੀ ਬਣਾਈ ਜਾਂਦੀ ਹੈ ਪਰ ਪੰਜਾਬ ਵਿੱਚ ਹੱਥ ਨਾਲ ਪੰਜਾਬੀ ਜੁੱਤੀ ਬਣਾਈ ਜਾਂਦੀ ਹੈ ਅਤੇ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਜਾਂਦਾ ਹੈ ਤਾਂ ਪੰਜਾਬੀ ਜੁੱਤੀ ਹੱਥ ਨਾਲ ਬਣਾਈ ਜਾਂਦੀ ਹੈ ਅਤੇ ਸਾਡੇ ਪੰਜਾਬ ਵਿੱਚ ਸ਼ਾਲ ਵੀ ਬਣਾਏ ਜਾਂਦੇ ਹਨ ਜਿਸ ਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਅਤੇ ਸਾਡੇ ਪੰਜਾਬ ਵਿੱਚ ਕਈ ਥਾਵਾਂ 'ਤੇ ਬਹੁਤ ਥਾਵਾਂ 'ਤੇ ਫੈਕਟਰੀ ਹਨ ਪਰ ਜ਼ਿਆਦਾਤਰ ਸਾਡੇ ਪੰਜਾਬ ਵਿੱਚ ਸ਼ਾਲ ਨੂੰ ਹੱਥ ਨਾਲ ਡਿਜ਼ਾਇਨ ਕੀਤਾ ਜਾਂਦਾ ਹੈ ਅਤੇ ਉਸ 'ਤੇ ਅਲਗ ਅਲਗ ਤਰ੍ਹਾਂ ਦੇ ਡਿਜ਼ਾਇਨ ਬਣਾਏ ਜਾਂਦੇ ਹਨ ਜਿਵੇਂ ਕਿ ਮੋਰ ਦਾ ਚਿੜੀਆਂ ਦਾ ਵੱਖ ਵੱਖ ਸਿਤਾਰੇ ਲਾ ਕੇ ਉਹਨੂੰ ਬਹੁਤ ਵਧੀਆ ਅਟਰੈਕਟਿਵ ਬਣਾਇਆ ਜਾਂਦਾ ਹੈ